ਹੈਲੋ ਵੀਰੇ ਮੈਂ ਤੁਹਾਡਾ ਇੱਕ ਪ੍ਰੋਡਕਟ ਲਿਆ ਸੀਗਾ ਜਿਹਦਾ ਨਾਮ ਸੀ ਮੋਹਿਤ ਹਰਬਲ ਕਰੀਮ ਜੋ ਕਿ ਛਾਈਆਂ ਵਾਸਤੇ ਤੁਸੀਂ ਬਣਾਉਂਦੇ ਹੋ ਉਹ ਮੈਨੂੰ ਬਹੁਤ ਹੀ ਵਧੀਆ ਪ੍ਰੋਡਕਟ ਲੱਗਿਆ ਤੁਹਾਡਾ ਅਤੇ ਉਹਦੇ ਨਾਲ ਮੈਂ ਇਕ ਮੈਂ ਸਿਰਫ਼ ਸੱਤ ਦਿਨ ਵਰਤਿਆ ਉਹਦਾ ਮੈਨੂੰ ਰਿਜਲਟ ਬਹੁਤ ਹੀ ਮਿਲਿਆ ਇਸ ਕਰਕੇ ਮੈਂ ਬਹੁਤ ਹੀ ਜਣਿਆਂ ਨੂੰ ਤੁਹਾਡੀ ਕਰੀਮ ਅੱਗੇ ਪ੍ਰੋਵਾਈਡ ਕਰਾਉਣ ਵਾਸਤੇ ਕਿਹਾ ਅਤੇ ਕਿਰਪਾ ਕਰਕੇ ਤੁਸੀਂ ਵੀ ਵੱਧ ਤੋਂ ਵੱਧ ਜ਼ ਮੈਨੂੰ ਕਰਵਾਓ ਕਿ ਮੈਂ ਤੁਹਾਡੀ ਸੇਲ ਕਰਾਵਾਂ ਮੈਨੂੰ ਇੰਨਾ ਸੋਹਣਾ ਅਤੇ ਜੈਨੂਨ ਪ੍ਰੋਡਕਟ ਲੱਗਿਆ ਤੁਹਾਡਾ ਅਤੇ ਮੈਨੂੰ ਇਹ ਪ੍ਰੋਡਕਟ ਲੈ ਕੇ ਬਹੁਤ ਖੁਸ਼ੀ ਹੋਈ ਹੈ ਮੈਂ ਆਪਣੇ ਪਰਿਵਾਰ ਫੈਮਲੀ ਮਿੱਤਰ ਸਾਰਿਆਂ ਨੂੰ ਇਹ ਪ੍ਰੋਡਕਟ ਵਰਤਣ ਦੇ ਮਾਰੇ ਵਰਤਣ ਬਾਰੇ ਮੈਂ ਕਹਿ ਰਿਹਾ ਅਤੇ ਮੈਨੂੰ ਇੰਨਾ ਵਧੀਆ ਜੈਨੂਨ ਮੇਰੇ ਕਈ ਲੱਖਾਂ ਰੁਪਈਏ ਕਰੋੜਾਂ ਰੁਪਈਏ ਬਚਾਏ ਨੇ ਜੋ ਮੇਰੇ ਦਾਗ ਸੀ ਮੇਰੇ ਜਾ ਨਹੀਂ ਰਹੇ ਸੀ ਮੈਂ ਬਹੁਤ ਹੀ ਦੂਜਾ ਜਗ੍ਹਾ ਜਗ੍ਹਾ ਜਾ ਕੇ ਦਿੱਲੀ ਬੰਬੇ ਕ ਚੇਨਈ ਕ ਕਲਕੱਤਾ ਅਮਰੀਕਾ ਕਨੇਡਾ ਜਾ ਕੇ ਮੈਂ ਵਰਤ ਕੇ ਦੇਖਿਆ ਜੋ ਕਿ ਮੈਨੂੰ ਕੋਈ ਫ਼ਾਇਦਾ ਨਹੀਂ ਹੋਇਆ ਤੁਹਾਡੇ ਪ੍ਰੋਡਕਟ ਨਾਲ ਮੈਨੂੰ ਬਹੁਤ ਹੀ ਬਹੁਤ ਹੀ ਬੈਸਟ ਰਿਜਲਟ ਮਿਲਿਆ ਥੈਂਕ ਯੂ ਧੰਨਵਾਦ